ਬਚਪਨ ਦੀਆਂ ਬੜੀਆਂ ਯਾਦਾਂ ਇਹੋ ਜਿਹੀਆਂ ਨੇ ਜਿਹਨਾਂ ਨੂੰ ਦੇਖ ਕੇ ਇੱਦਾਂ ਲੱਗਦਾ ਬਚਪਨ ਦੁਬਾਰਾ ਆ ਜਾਵੇ ਜਿਵੇਂ ਉਦੋਂ ਹੁੰਦਾ ਵੀ ਬਸ ਖੇਡੀ ਜਾਓ ਖੇਡੀ ਜਾਓ ਖੇਡੀ ਜਾਓ ਖਾਓ ਖੇਡੋ ਬੱਸ ਸੌਂ ਜੋ ਨਜ਼ਾਰੇ ਲਓ ਜ਼ਿੰਦਗੀ ਦੇ ਬ ਆਹੀ ਚੀਜ਼ਾਂ ਬਚਪਨ ਨੂੰ ਖਾਸ ਬਣਾਉਂਦੀਆਂ ਵੀ ਕਿਸੇ ਚੀਜ਼ ਦੀ ਚਿੰਤਾ ਨਹੀਂ ਬਸ ਆਪਣੀ ਜ਼ਿੰਦਗੀ ਜੀਓ ਅਤੇ ਨਜ਼ਾਰੇ ਲਓ